ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਫੂਡ ਵਲੋਗਰ ਬੋਲਣ ਡੀ ਹਾਂ ਜੀ ਮੈਂ ਤੁਹਾਨੂੰ ਪੁੱਛਣਾ ਸੀ ਕਿ ਤੁਹਾਡੇ ਇਲਾਕੇ ਵਿੱਚ ਕਿੱਥੇ ਕਿੱਥੇ ਜਾ ਕੇ ਮੈਂ ਆਪਣੇ ਵਲੋਗ ਬਣਾ ਸਕਦੀ ਹਾਂ ਅੱਛਾ ਅੱਛਾ ਅਤੇ ਇੱਥੇ ਸਫਾਈ ਸਫੂਈ ਚੰਗੀ ਹੈ ਨਾ ਵਧੀਆ ਨਾ ਅਤੇ ਰੌਲਾ ਰੂਲਾ ਹੁੰਦਾ ਉੱਥੇ ਨਹੀਂ ਹੁੰਦਾ ਹਾਂਜੀ ਤੁਹਾਨੂੰ ਪਤਾ ਨਾ ਫਿਰ ਵਲੋਗ ਬਣਾਉਣਾ ਅਗਰ ਕ ਅਸੀਂ ਮਾੜੇ ਰੀਵਿਊ ਦੇਵਾਂਗੇ ਫਿਰ ਉਨ੍ਹਾਂ ਨੇ ਕਹਿਣਾ ਵਧੀਆ ਜਗ੍ਹਾ ਹੋਣੀ ਚਾਹੀਦੀ ਆ ਅੱਛਾ ਅੱਛਾ ਹਾਂਜੀ ਅਤੇ ਖੁੱਲ੍ਹੇ ਕਿੰਨੇ ਵਜੇ ਤੱਕ ਹੁੰਦੇ ਆ ਅੱਛਾ ਅੱਛਾ ਅੱਛਾ ਐਤਵਾਰ ਨੂੰ ਕੀ ਸੀਨ ਹੈ ਅੱਛਾ ਅੱਛਾ ਹੋਰ ਹੋਰ ਕੋਈ ਜਗ੍ਹਾ ਹੋਏਗੀ ਇਹਨਾਂ ਤੋਂ ਇਲਾਵਾ ਅੱਛਾ ਅੱਛਾ ਫਿਰ ਤੁਸੀਂ ਮੇਰੀ ਯੂਟਿਊਬ 'ਤੇ ਵਲੋਗ ਵਗੈਰਾ ਦੇਖਦੇ ਹੋ ਚਲੋ ਕੋਈ ਨਾ ਦੇਖਿਆ ਕਰੋ ਹਾਂਜੀ ਚਲੋ ਓਕੇ ਬਾਏ